ਪਹਿਲੇ ਸਮਿਆਂ 'ਚ ਕਾਗਜ਼ੀ ਕੰਮ ਦੀ ਹੀ ਕਦਰ ਅਤੇ ਬੁਕਤ ਸੀ ਪਰ ਅਜੋਕੇ ਸਮੇਂ 'ਚ ਕੰਪਿਊਟਰ ਦੀ ਮਦਦ ਨਾਲ ਮਨੁੱਖ ਦਾ ਜ਼ਿਆਦਾਤਰ ਕੰਮ ਡੇਟਾ ਦਾ ਰੂਪ ਧਾਰ ਕੇ ਔਨਲਾਈਨ ਹੋ ਗਿਆ ਹੈ ਕਿਸੇ ਵੀ ਪ੍ਰਕਿਰਿਆ ਨੂੰ ਅਖੀਰਲੀ ਸ਼ਕਲ ਦੇਣ 'ਚ ਡੇਟਾ ਦੀ ਬਹੁਤ ਸਹਾਇਤਾ ਹੁੰਦੀ ਹੈ ਜਿਵੇਂ ਦਫਤਰ 'ਚ ਬੈਠਾ ਇੱਕ ਮੁਲਾਜ਼ਮ ਪੰਜਾਹ ਬੰਦਿਆਂ ਅਤੇ ਉਹਨਾਂ ਦੇ ਮੋਬਾਈਲ ਨੰਬਰ ਨਾਲ ਐਡਰੈਸ ਲਿਖਣਾ ਚਾਹੁੰਦਾ ਹੈ ਉਹ ਇਸ ਨੂੰ ਇੱਕ ਜਗ੍ਹਾ ਇਕੱਤ੍ਰਿਤ ਕਰਕੇ ਟਾਈਪ ਕਰਦਾ ਹੈ ਅਤੇ ਅਖੀਰ 'ਚ ਜੋ ਲਿਸਟ ਬਣ ਕੇ ਤਿਆਰ ਹੋਈ ਉਸ ਨੂੰ ਅਸੀਂ ਡੇਟਾ ਕਹਿੰਦੇ ਹਾਂ ਫਿਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖ ਲਵੋ ਉਹਨਾਂ ਕੋਲ ਮੋਬਾਈਲ ਲੈਪਟੋਪ ਵਰਗੀ ਹਰ ਸਹੂਲਤ ਹੈ ਜਿਹਦੇ ਨਾਲ ਉਹ ਅਸਲ ਦੁਨੀਆ ਨੂੰ ਕਿਸੇ ਗੇਮ ਦੇ ਰੂਪ 'ਚ ਆਰਟੀਫਿਸ਼ੀਅਲ ਦੁਨੀਆ ਬਣਾ ਕੇ ਖੇਡ ਸਕਦੇ ਹਨ ਇਹਦੇ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਆਉਣ ਵਾਲੇ ਕੁਝ ਕੁ ਸਾਲਾਂ 'ਚ ਸਾਡੇ ਨਿੱਜੀ ਜੀਵਨ 'ਚ ਇਹ ਨਵੀਨਤਾਵਾਂ ਬਹੁਤ ਵੱਡਾ ਕਿਰਦਾਰ ਨਿਭਾ ਸਕਦੀਆਂ ਹਨ ਧੰਨਵਾਦ